ਸਾਡੇ ਇਲਾਕੇ ਦੇ ਜਿਹੜੇ ਐਮ ਐਲ ਏ ਹਨ ਉਹ ਜਗਰੂਪ ਸਿੰਘ ਗਿੱਲ ਜੀ ਹਨ ਮੈਂ ਉਹਨਾਂ ਨਾਲ ਕਦੇ ਡਾਇਰੈਕਟਲੀ ਸਿੱਧੇ ਤੌਰ 'ਤੇ ਗੱਲਬਾਤ ਤਾਂ ਨਹੀਂ ਕੀਤੀ ਪਰ ਉਹਨਾਂ ਦਾ ਭਾਸ਼ਣ ਜਰੂਰ ਸੁਣਿਆ ਉਹਨਾਂ ਨੂੰ ਖਬਰਾਂ ਦੇ ਵਿੱਚ ਜਰੂਰ ਸੁਣਿਆ ਉਹ ਉਹਨਾਂ ਨੇ ਬਠਿੰਡੇ ਨੂੰ ਜਾਂ ਸਾਡੇ ਏਰੀਏ ਨੂੰ ਲੈ ਕੇ ਕਈ ਮਹੱਤਵਪੂਰਨ ਕੰਮ ਕੀਤੇ ਨੇ ਜਿਵੇਂ ਕਿ ਲੋਕਾਂ ਦੀ ਜੋ ਵੀ ਤਕਲੀਫਾਂ ਹੁੰਦੀਆਂ ਨੇ ਉਹ ਸੁਣਦੇ ਆ ਉਹਨਾਂ ਨੂੰ ਅਤੇ ਉਸਦੇ ਕੰਮ ਵੀ ਕਰਦੇ ਨੇ ਬਾਕੀ ਜਿਹੜਾ ਵੈਲਫੇਅਰ ਵਾਸਤੇ ਐ ਉਹ ਉਹਦੇ ਬਾਰੇ ਵੀ ਉਹ ਕਾਫੀ ਧਿਆਨ ਰੱਖਦੇ ਨੇ ਸਾਰਾ ਕੰਮ ਕਰਦੇ ਨੇ ਗੱਲ ਸੁਣਦੇ ਨੇ ਲੋਕਾਂ ਦੀ ਜੋ ਵੀ ਕੋਈ ਉਹਨਾਂ ਕੋਲੇ ਜਾਂਦਾ ਆ ਬਿਠਾ ਕੇ ਗੱਲ ਸੁਣਦੇ ਨੇ ਅਤੇ ਉਸਦੇ ਕੰਮ ਵੀ ਕਰਦੇ ਨੇ ਅੱਗੇ ਬਠਿੰਡੇ ਦੀ ਡਿਵੈਲਪਮੈਂਟ ਵਾਸਤੇ ਵੀ ਉਹਨਾਂ ਨੇ ਕਾਫੀ ਪਹਿਲ ਕਦਮੀਆਂ ਚੁੱਕੀਆਂ ਨੇ ਸਰਕਾਰ ਦੇ ਮੌਜੂਦਾ ਸਰਕਾਰ ਦੇ ਨਾਲ ਰਲ ਕੇ ਉਹਨਾਂ ਨੇ ਕਈ ਕੰਮ ਕੀਤੇ ਨੇ ਕਿਵੇਂ ਕੀ ਸੜਕਾਂ ਬਣਵਾਈਆਂ ਨੇ ਹੋਰ ਵੀ ਕਈ ਕੰਮ ਕੀਤੇ ਨੇ